ਹਾਂਜੀ ਮੈਨੂੰ ਯਾਦ ਹੈ ਕੇਰਾਂ ਮੈਂ ਅੱਠਵੀਂ ਕਲਾਸ 'ਚ ਪੜ੍ਹਦਾ ਸੀ ਉਦੋਂ ਮੈਂ ਇੱਕ ਡਰਾਇੰਗ ਬਣਾਈ ਸੀ ਕ੍ਰਿਸ਼ਨ ਅਤੇ ਅਰਜੁਨ ਦੀ ਗੀਤਾ ਦਾ ਉਪਦੇਸ਼ ਦਿੰਦੇ ਹੋਏ ਕ੍ਰਿਸ਼ਨ ਜੀ ਅਰਜੁਨ ਨੂੰ ਉਹ ਡਰਾਇੰਗ ਮੈਂ ਉਦੋਂ ਉਸ ਵੇਲੇ ਅੱਠਵੀਂ ਕਲਾਸ ਵਿੱਚ ਪੜ੍ਹਦਾ ਸੀ ਡਰਾਇੰਗ ਬਹੁਤ ਹੀ ਸੋਹਣੀ ਬਣੀ ਯਾਨੀ ਦੀ ਜਿੰਨੀ ਮੈਨੂੰ ਉਮੀਦ ਨਹੀਂ ਸੀ ਉਸ ਤੋਂ ਜ਼ਿਆਦਾ ਸੋਹਣੀ ਬਣੀ ਉਸ ਵਿੱਚ ਰੰਗ ਰੁੰਗ ਬਹੁਤ ਵਧੀਆ ਭਰੇ ਗਏ ਕ੍ਰਿਸ਼ਨ ਜੀ ਉਵੇਂ ਜਿੱਦਾਂ ਖੜੇ ਹਨ ਗੀਤਾ ਦਾ ਉਪਦੇਸ਼ ਦੇ ਰਹੇ ਹਨ ਕ੍ਰਿਸ਼ਨ ਜੀ ਹੱਥ ਜੋੜ ਕੇ ਥੱਲੇ ਉਹਨਾਂ ਦੇ ਪੈਰਾਂ 'ਚ ਬੈਠੇ ਉਪਦੇਸ਼ ਲੈ ਰਹੇ ਨੇ ਬਹੁਤ ਵਧੀਆ ਡਰਾਇੰਗ ਬਣ ਗਈ ਸੀ ਉਸ 'ਤੇ ਮੈਨੂੰ ਬੜਾ ਮਾਣ ਹੈ ਕਿਉਂਕਿ ਮੇਰੇ ਮਾਂ ਪਿਓ ਸਾਡੇ ਆਂਢੀ ਗੁਆਂਢੀ ਰਿਸ਼ਤੇਦਾਰ ਜੋ ਵੀ ਆਉਂਦੇ ਉਹਨਾਂ ਨੂੰ ਜ਼ਰੂਰ ਦਿਖਾਉਂਦੇ ਸਾਡੇ ਘਰ ਦੇ ਵੀ ਇਹ ਦੇਖੋ ਜੀ ਆਪਣੇ ਬੱਚੇ ਨੇ ਡਰਾਇੰਗ ਬਣਾਈ ਹੈ ਉਹ ਸਾਰੇ ਕਹਿੰਦੇ ਵੀ ਯਾਰ ਕਿਆ ਬਾਤ ਬਹੁਤ ਸੋਹਣੀ ਬਣਾਈ ਹੈ ਬਹੁਤ ਅੱਛੀ ਡਰਾਇੰਗ ਬਣਾਈ ਹੈ ਫਿਰ ਸਾਡੇ ਇੱਥੇ ਨਾਲ ਮੰਦਰ ਹੈ ਡੇਰਾ ਹੈ ਉੱਥੇ ਬਾਬੇ ਆਉਂਦੇ ਹੁੰਦੇ ਨੇ ਭੰਡਾਰਾ ਕਰਦੇ ਨੇ ਸਾਲ ਬਾਅਦ ਹਰਿਦੁਆਰ ਤੋਂ ਆ ਕੇ ਉਹਨਾਂ ਨੂੰ ਦਿਖਾਈ ਸਪੈਸ਼ਲ ਤੌਰ 'ਤੇ ਉਹਨਾਂ ਨੇ ਮੈਨੂੰ ਮਾਣ ਬਖਸ਼ਿਆ ਉਹਨਾਂ ਨੇ ਮੈਨੂੰ ਇਨਾਮ ਵੀ ਦਿੱਤਾ ਅਤੇ ਉਹ ਉਹਨਾਂ ਨੇ ਬੜਾ ਮੈਨੂੰ ਪ੍ਰਸ਼ੰਸਾ ਕੀਤੀ ਕਹਿੰਦੇ ਜੀ ਬਹੁਤ ਅੱਛੀ ਛੋਟੇ ਇੰਨੇ ਛੋਟੇ ਬੱਚੇ ਨੇ ਇੰਨੀ ਵਧੀਆ ਡਰਾਇੰਗ ਬਣਾ ਦਿੱਤੀ ਬਹੁਤ ਤਾਰੀਫ਼ ਕੀਤੀ ਉਹਨਾਂ ਨੇ ਮੇਰੀ ਅਤੇ ਫਿਰ ਦੋਸਤਾਂ ਮਿੱਤਰਾਂ ਨੂੰ ਮੈਂ ਦਿਖਾਉਂਦਾ ਰਿਹਾ ਦੇਖੋ ਜੀ ਸਭ ਨੇ ਬਹੁਤ ਤਾਰੀਫ਼ ਕੀਤੀ ਉਸ ਤੋਂ ਬਾਅਦ ਮੇਰਾ ਇੰਟਰਸਟ ਹੋਰ ਬਣ ਗਿਆ ਉਹ ਤੋਂ ਬਾਅਦ ਮਤਲਬ ਸਾਰਿਆਂ ਵਿੱਚ ਛਬੀ ਇਸ ਤਰ੍ਹਾਂ ਬਣ ਗਈ ਹੈ ਕਿ ਵਧੀਆ ਕਲਾਕਾਰ ਹੈ ਅਤੇ ਵਧੀਆ ਪੇਂਟਰ ਹੈ ਤਾਂ ਉਸ ਤੋਂ ਬਾਅਦ ਮੇਰਾ ਵੀ ਉਤਸ਼ਾਹ ਵਧ ਗਿਆ ਮੈਂ ਹੋਰ ਡਰਾਇੰਗਾਂ ਹੋਰ ਪੇਂਟਿੰਗਾਂ ਬਣਾਉਣ ਲੱਗ ਗਿਆ ਅਤੇ ਲੋਕ ਵੀ ਇਹ ਫੀਡਬੈਕ ਦਿੰਦੇ ਸੀ ਵੀ ਤੂੰ ਯਾਰ ਹੋਰ ਸਿੱਖ ਲੈ ਚੰਗੀ ਤਰ੍ਹਾਂ ਤੂੰ ਬਹੁਤ ਵਧੀਆ ਪੇਂਟਰ ਬਣ ਸਕਦਾ ਅਤੇ ਮੈਂ ਬਹੁਤ ਸਾਰੀਆਂ ਡਰਾਇੰਗਾਂ ਬਣਾਈਆਂ ਉਸ ਤੋਂ ਬਾਅਦ ਤਾਂ ਸਾਰੀਆਂ ਡਰਾਇੰਗਾਂ ਬਾਰੇ ਲੋਕਾਂ ਦੀ ਫੀਡਬੈਕ ਬਹੁਤ ਅੱਛੀ ਆ ਰਹੀ ਹੈ ਹੁਣ ਵੀ ਮੈਂ ਜੇ ਕੋਈ ਕੰਮ ਕਰਦਾ ਹਾਂ ਤਾਂ ਲੋਕ ਪਹਿਲ ਦੇ ਅਧਾਰ 'ਤੇ ਮੈਨੂੰ ਕਹਿੰਦੇ ਨੇ ਵੀ ਪਹਿਲਾਂ ਸਾਨੂੰ ਦਿਖਾਈ ਵੀ ਕੀ ਬਣਾਇਆ ਤੈਂ ਲੋਕ ਉਸਦੀਆਂ ਫੋਟੋਆਂ ਖਿੱਚਦੇ ਨੇ ਆਪਣੇ ਸਟੇਟਸ ਵਗੈਰਾ ਲਗਾਉਂਦੇ ਨੇ ਮੇਰੀ ਬਣਾਈ ਕਲਾ ਕਿਰਤੀ ਦੀ ਅਤੇ ਮੈਂ ਚਾਹੁੰਦਾ ਵੀ ਮੈਂ ਵੀ ਇੱਕ ਆਪਣਾ ਇੱਕ ਪ੍ਰਦਰਸ਼ਨੀ ਲਗਾਵਾਂ ਜਿਸ ਵਿੱਚ ਲੋਕ ਮੇਰੀਆਂ ਡਰਾਇੰਗਾਂ ਦੇਖਣ ਅਤੇ ਸਭ ਤੋਂ ਵੱਧ ਮਾਣ ਮੈਨੂੰ ਆਪਣੇ ਓ ਉਸ ਡਰਾਇੰਗ 'ਚੋਂ ਹੋਵੇਗਾ ਜੋ ਮੈਂ ਸਭ ਤੋਂ ਪਹਿਲਾਂ ਬਣਾਈ ਸੀ ਵੀ ਇੰਨੀ ਛੋਟੀ ਉਮਰ ਦੇ ਵਿੱਚ ਉਹ ਮੇਰੇ ਤੋਂ ਇੰਨੀ ਸੋਹਣੀ ਕਿਵੇਂ ਬਣੀ ਸੀ ਮੈਂ ਖੁਦ ਹੈਰਾਨ ਹਾਂ ਲੋਕ ਵੀ ਜੋ ਦੇਖਦੇ ਨੇ ਅਜੇ ਤੱਕ ਵੀ ਉਹ ਮੇਰੇ ਕੋਲ ਸਾਂਭ ਕੇ ਰੱਖੀ ਹੋਈ ਹੈ ਸਭ ਦੇਖਦੇ ਨੇ ਅਤੇ ਸ਼ਾਬਾਸ਼ ਦਿੰਦੇ ਨੇ ਕਿ ਇੱਕ ਛੋਟੇ ਜਿਹੇ ਬੱਚੇ ਨੇ ਕਿੰਨੀ ਸੋਹਣੀ ਡਰਾਇੰਗ ਬਣਾਈ